ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਵਹਿਮਾਂ ਭਰਮਾਂ ਬਾਰੇ ਦੱਸਣ ਜਾ ਰਹੀ ਹਾਂ ਜਿਸ 'ਤੇ ਮੈਂ ਅਤੇ ਮੇਰੇ ਇਲਾਕੇ ਦੇ ਲੋਕ ਬੜੀ ਮਜ਼ਬੂਤੀ ਨਾਲ ਵਿਸ਼ਵਾਸ ਕਰਦੇ ਹਨ ਜੋ ਕਿ ਵਹਿਮ ਭਰਮ ਹਨ ਜਿਵੇਂ ਵੀਰਵਾਰ ਸਿਰ ਨਹੀਂ ਧੋਣਾ ਚਾਹੀਦਾ ਸਿਰ ਉੱਤੇ ਤੇਲ ਨਹੀਂ ਲਾਉਣਾ ਚਾਹੀਦਾ ਕਿਉਂਕਿ ਇਹ ਗੁਰੂ ਪੀਰਾਂ ਦਾ ਦਿਨ ਮੰਨਿਆ ਜਾਂਦਾ ਹੈ ਇਸ ਦਿਨ ਲੋਕ ਚਿਰਾਗ ਉੱਤੇ ਜਾ ਕੇ ਤੇਲ ਪਾਉਂਦੇ ਹਨ ਅਤੇ ਇਸ ਲਈ ਮੰਨਿਆ ਜਾਂਦਾ ਹੈ ਕਿ ਮੈਂ ਸਿਰ ਵਿੱਚ ਤੇਲ ਨਹੀਂ ਪਾਉਣਾ ਚਾਹੀਦਾ ਪਹਿਲੇ ਦਿਨ ਤਾਂ ਮੈਂ ਇਸ ਗੱਲ ਉੱਤੇ ਯਕੀਨ ਨਹੀਂ ਸੀ ਕਰਦੀ ਪਰ ਇੱਕ ਦਿਨ ਬਚਪਨ ਵਿੱਚ ਮੈਂ ਇਸ ਦਿਨ ਸਿਰ ਧੋ ਲਿਆ ਅਤੇ ਫਿਰ ਇਹ ਮੇਰੇ ਸਿਰ ਉੱਤੇ ਭਾਰੂ ਹੋ ਗਿਆ ਮੈਂ ਕਿੰਨੇ ਦਿਨ ਬਿਮਾਰ ਰਹੀ ਉਸ ਦਿਨ ਤੋਂ ਮੈਂ ਇਹਨਾਂ ਵਹਿਮਾਂ ਭਰਮਾਂ 'ਤੇ ਯਕੀਨ ਕਰਨਾ ਸ਼ੁਰੂ ਕਰ ਦਿੱਤਾ ਹੁਣ ਇਸ 'ਤੇ ਮੈਂ ਬਹੁਤ ਯਕੀਨ ਕਰਦੀ ਹਾਂ ਅਤੇ ਅੱਗੇ ਆਪਣੇ ਬੱਚਿਆਂ ਨੂੰ ਵੀ ਇਸ ਵਹਿਮ ਭਰਮ ਨੂੰ ਮੰਨਣ ਲਈ ਕਹਿੰਦੀ ਹਾਂ ਧੰਨਵਾਦ ਜੀ